ਪਿੰਡਾਂ ਵਿੱਚ ਕਦੇ ਵੀ ਪਾਣੀ ਦੀ ਘਾਟ ਨਹੀਂ ਪੈ ਸਕਦੀ ਅਤੇ ਨਾ ਹੀ ਸੋਕੇ ਦੀ ਕਮੀ ਆ ਸਕਦੀ ਹੈ ਕਿਉਂਕਿ ਪਿੰਡਾਂ ਵਿੱਚ ਸ਼ਹਿਰਾਂ ਨਾਲੋਂ ਮੌਸਮ ਵਾਤਾਵਰਨ ਬਹੁਤ ਵਧੀਆ ਹੈ ਸ਼ਹਿਰਾਂ ਵਿੱਚ ਫੈਕਟਰੀਆਂ ਲੱਗਣ ਕਰਕੇ ਜਾਂ ਕੁਝ ਹੋਰ ਗੱਲਾਂ ਕਰਕੇ ਪ੍ਰਦੂਸ਼ਣ ਬਹੁਤ ਹੁੰਦਾ ਹੈ ਪਿੰਡਾਂ ਵਿੱਚ ਥੋੜ੍ਹਾ ਠੀਕ ਠਾਕ ਹੀ ਹੁੰਦਾ ਹੈ ਜਿਸ ਕਾਰਨ ਪਾਣੀ ਦੀ ਘਾਟ ਸਾਡੇ ਪਿੰਡ ਤਾਂ ਕਦੇ ਨਹੀਂ ਪਈ ਅਤੇ ਪਿੰਡਾਂ ਵਿੱਚ ਖੇਤਾਂ ਕਰਕੇ ਅਤੇ ਹੋਰ ਲੋਕਾਂ ਨੇ ਜ਼ਮੀਨਾਂ ਕਰਕੇ ਮੋਟਰਾਂ ਟਿਊਬਵੈੱਲ ਜੋ ਕਿ ਰੋਜ਼ ਸਿੰਜਾਈ ਲਈ ਵਰਤੇ ਜਾਂਦੇ ਨੇ ਜਿਨ੍ਹਾਂ ਕਰਕੇ ਸੋਕਾ ਪੈਣ ਦੀ ਸੰਭਾਵਨਾ ਤਾਂ ਨਾਮਾਤਰ ਹੀ ਹੁੰਦੀ ਆ ਅਤੇ ਪਾਣੀ ਦੀ ਘਾਟ ਵੀ ਕਦੇ ਨਹੀਂ ਹੋਈ ਜਿਸ ਕਾਰਨ ਕਈ ਅਜਿਹੇ ਹਨ ਜੋ ਕਿ ਪਿਛੜੇ ਹਨ ਜੀ ਪਿਛੜੇ ਪਿੰਡ ਸ਼ਹਿਰਨ ਜਿੱਥੇ ਕਈ ਵਾਰ ਹੋ ਜਾਂਦੀ ਆ ਪਾਣੀ ਦੀ ਘਾਟ ਪਰ ਸਾਡੇ ਪਿੰਡ ਵਿੱਚ ਕਦੇ ਵੀ ਪਾਣੀ ਦੀ ਘਾਟ ਨਹੀਂ ਹੋਈ